ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਪੰਜਾਬੀਆਂ ਦਾ ਇੱਕ ਅਹਿਮ ਕਿੱਤਾ ਹੈ ਜਿਸ ਨੂੰ ਸ਼ੌਂਕ ਨਾਲ ਕਰਦੇ ਹਾਂ ਮੇਰੇ ਕੋਲ ਪੰਦਰਾਂ ਮੱਝਾਂ ਹਨ ਦੋ ਨੌਕਰ ਰੱਖੇ ਹਨ ਮੇਰਾ ਖੇਤੀ ਫਾਰਮ ਖੇਤਾਂ ਵਿੱਚ ਬਣਾਇਆ ਹੈ ਸਵੇਰੇ ਉੱਠ ਕੇ ਚਾਰ ਵਜੇ ਮੈਂ ਆਪਣੇ ਨਾਲ ਦੋ ਨੌਕਰਾਂ ਨੂੰ ਲਾ ਕੇ ਸਵੇਰੇ ਉਹਨਾਂ ਨੂੰ ਪਹਿਲਾਂ ਮੋਰਨਿੰਗ ਟਾਈਮ ਚਾਰ ਵਜੇ ਚਾਰਾ ਅਤੇ ਫੀਡ ਪਾਉਂਦਾ ਸਾਢੇ ਪੰਜ ਵਜੇ ਮੈਂ ਮੱਝਾਂ ਚੋਣ ਲੱਗ ਜਾਂਦਾ ਜੋ ਕਿ ਨੌਕਰਾਂ ਦੇ ਨਾਲ ਮੇਰੇ ਨਾਲ ਲੱਗ ਕੇ ਅਸੀਂ ਮੱਝਾਂ ਚੋਂਦੇ ਹਾਂ ਉਸ ਤੋਂ ਬਾਅਦ ਅਸੀਂ ਜਿਹੜਾ ਦੁੱਧ ਦੁੱਧ ਅਸੀਂ ਮਿਣ ਮਿਣ ਕੇ ਜਿਹੜੇ ਵੀ ਸਾਡੇ ਕੋਲ਼ ਲੋਕ ਆਉਂਦੇ ਨੇ ਉਹਨਾਂ ਨੂੰ ਅਸੀਂ ਬਿਨਾਂ ਮਿਲਾਵਟ ਤੋਂ ਦੁੱਧ ਦਿੰਦੇ ਹਾਂ ਉਸ ਤੋਂ ਬਾਅਦ ਜਿਹੜਾ ਸ ਦੁੱਧ ਸਾਡੇ ਕੋਲ਼ ਬਣ ਜਾਂਦਾ ਹੈ ਉਸਦੇ ਅਸੀਂ ਪ੍ਰੋਡਕਟ ਬਣਾਉਂਦੇ ਹਾਂ ਜਿਵੇਂ ਕਿ ਪਨੀਰ ਵਗੈਰਾ ਜਾਂ ਖੋਆ ਵਗੈਰਾ ਮਾਰ ਕੇ ਅਸੀਂ ਸ਼ਹਿਰਾਂ ਦੇ ਵਿੱਚ ਆਪ ਸੇਲ ਕਰਨ ਜਾਂਦੇ ਹਾਂ ਜਿਵੇਂ ਕਿ ਕੋਈ ਦਿਨ ਤਿਉਹਾਰ ਆਉਂਦਾ ਹੈ ਉਸ ਦਿਨ ਸਾਡੇ ਕੋਲ ਦੁੱਧ ਦੀ ਇੰਨੀ ਕੁ ਸ਼ੋਰਟੇਜ ਹੋ ਜਾਂਦੀ ਹੈ ਕਿ ਲੋਕ ਹਰੇਕ ਬੰਦਾ ਅੱਜ ਦੇ ਟਾਈਮ ਦੇ ਵਿੱਚ ਰੈਲਟੀ ਚੀਜ਼ ਪਸੰਦ ਕਰਦਾ ਹੈ ਬਿਨਾਂ ਕਿਸੇ ਮਿਲਾਵਟ ਤੋਂ ਇਸ ਕਰਕੇ ਸਾਡਾ ਜਿਹੜਾ ਖੇਤੀ ਦਾ ਨਾਲ ਨਾਲ ਪਸ਼ੂ ਪਾਲਣ ਦਾ ਕਿ ਕਿੱਤਾ ਵਾ ਅਸੀਂ ਸ਼ੌਂਕ ਨਾਲ ਪਾਲਦੇ ਹਾਂ ਅਸੀਂ ਪਿੰਡ ਦੇ ਵਿੱਚ ਰਹਿੰਦੇ ਹਾਂ ਸਾਡੇ ਪਿੰਡ ਦੇ ਕੋਲ ਇੱਕ ਨਹਿਰ ਹੈ ਜਿੱਥੇ ਕਿ ਅਸੀਂ ਮੱਝਾਂ ਨੂੰ ਡੇਲੀ ਰੋਜ਼ਾਨਾ ਨਹਿਰ ਦੇ ਵਿੱਚੋਂ ਜਾਂਦੀਆਂ ਨੇ ਨਹਾ ਕੇ ਬਹੁਤ ਖੁਸ਼ ਹੁੰਦੀਆਂ ਹਨ ਅਤੇ ਆ ਕੇ ਉਹ ਇਕ ਕਿੱਲੋਮੀਟਰ ਦੇ ਫਿਰ ਆ ਕੇ ਉਹ ਰਸਤੇ ਦੇ ਵਿੱਚ ਚਾਰਾ ਚਰਦੀਆਂ ਹਨ ਚਾਰਾ ਚਰਨ ਤੋਂ ਬਾਅਦ ਅਸੀਂ ਦੁਬਾਰਾ ਸ਼ਾਮ ਨੂੰ ਆ ਕੇ ਉਹਨਾਂ ਨੂੰ ਬੰਨ ਦਿੰਦੇ ਹਾਂ ਅਤੇ ਸ਼ਾਮ ਨੂੰ ਛੇ ਵਜੇ ਅਸੀਂ ਉਹਨਾਂ ਨੂੰ ਫਿਰ ਚੋ ਕੇ ਫਿਰ ਉਹਨਾਂ ਨੂੰ ਅੱਠ ਵਜੇ ਆਪਣੇ ਲਾ ਕੇ ਪੱਖੇ ਵਗੈਰਾ ਲਾ ਕੇ ਉਹਨਾਂ ਨੂੰ ਆਰਾਮ ਦੇ ਨਾਲ ਅਸੀਂ ਪਾ ਦਿੰਦੇ ਹਾਂ ਅਤੇ ਸਵੇਰੇ ਸਾਡੀ ਫਿਰ ਇਸੇ ਟੈਮ ਦੁਆਰਾ ਰੂਟੀਨ ਤੁਰ ਪੈਂਦੀ ਹੈ